ਸੰਗੀਤ ਅਤੇ ਸਾਜ ਦੋਨੋਂ ਬਹੁਤ ਹੀ ਪਿਆਰੇ ਸ਼ਬਦ ਨੇ ਅਤੇ ਜਿੰਨੇ ਇਹ ਪਿਆਰੇ ਸ਼ਬਦ ਨੇ ਉੰਨੀ ਇਹਨਾਂ ਦੀ ਜਿਹੜੀ ਹੈਗੀ ਹੈ ਗਹਿਨਤਾ ਉਹ ਬਹੁਤ ਹੀ ਸੁਣ ਕੇ ਹੀ ਮਜ਼ਾ ਆ ਜਾਂਦਾ ਜਿਵੇਂ ਕਿ ਹੁਣ ਆਪਾਂ ਗਾਣੇ ਜਿਹੜੇ ਵੀ ਆਉਂਦੇ ਨੇ ਉਹਨਾਂ ਦੇ ਵਿੱਚ ਜਿਹੜੀ ਸਾਜਾਂ ਦੀ ਆਵਾਜ਼ ਹੈ ਉਸ ਨੂੰ ਉਹ ਇੱਕ ਹੋਰ ਹੀ ਦਿਸ਼ਾ ਦੇ ਵਿੱਚ ਲਿਜਾ ਕੇ ਬਹੁਤ ਹੀ ਮਨਮੋਹਕ ਬਣਾ ਦਿੰਦੀ ਹੈ ਮੇਰਾ ਇਹ ਮੰਨਣਾ ਕਿ ਮੈਂ ਵੀ ਸਿਤਾਰ ਸਿੱਖਾਂ ਸਿਤਾਰ ਮੈਨੂੰ ਬਹੁਤ ਵਧੀਆ ਲੱਗਦੀ ਹੈ ਪਰ ਉਹ ਹੈ ਬਹੁਤ ਮਹਿੰਗੀ ਤਾਂ ਕਰਕੇ ਖਰੀਦਣਾ ਤਾਂ ਉਹਨੂੰ ਹੈਗਾ ਮਹਿੰਗਾ ਮ ਮਤਲਬ ਖਰੀਦਣਾ ਤਾਂ ਹੈਗਾ ਉਹਨੂੰ ਬਹੁਤ ਮੁਸ਼ਕਿਲ ਪਰ ਮੈਂ ਚਾਹੁੰਦੀ ਹਾਂ ਕਿ ਕਿਸੇ ਇੰਸਟੀਟਿਊਟ ਦੇ ਵਿੱਚ ਲੱਗ ਕੇ ਮੈਂ ਉੱਥੇ ਉਸਦੀ ਪ੍ਰੈਕਟਿਸ ਕਰਾਂ ਤਾਂ ਕਿ ਮੈਂ ਆਪਣੀ ਦਿਲ ਦੀ ਜਿਹੜੀ ਤਮੰਨਾ ਹੈਗੀ ਹੈ ਉਹ ਪੂਰੀ ਕਰਾਂ ਅਤੇ ਮੈਂ ਉਹ ਸਾਜ ਨੂੰ ਸਿੱਖ ਕੇ ਅਤੇ ਆਨੰਦ ਲਵਾਂ ਉਹ ਸਾਜ ਦਾ ਅਤੇ ਮੈਂ ਆਪਣੇ ਦਿਲ ਦੀ ਇੱਛਾ ਵੀ ਪੂਰੀ ਕਰ ਲਵਾਂ ਸਿਤਾਰ ਸਿੱਖ ਕੇ